ਹੈਲੋੇ ਸਤਿ ਸ਼੍ਰੀ ਅਕਾਲ ਜੀ

ਮੈਡਮ ਜੀ ਜਿੰਨਾ ਤੁਸੀਂ ਗੁੜ ਦਾ ਇਸਤੇਮਾਲ ਕਰੋਗੇ ਉਹਨਾਂ ਤੁਹਾਡੀ ਸਿਹਤ ਲਈ ਵਧੀਆ ਹੋਏਗਾ ਤੁਹਾਡੇ ਹਾਜ਼ਮੇ ਲਈ ਬਹੁਤ ਵਧੀਆ ਹੁੰਦਾ ਗੁੜ ਅਸੀਂ ਤਾਂ ਜਿਹੜਾ ਵੀ ਸਾਨੂੰ ਕੋਈ ਪੁੱਛਦਾ ਅਸੀਂ ਤਾਂ ਆਹੀ ਕਹਿੰਦੇ ਤੁਸੀਂ ਗੁੜ ਦੀ ਵੱਧ ਤੋਂ ਵੱਧ ਇਸਤੇਮਾਲ ਕਰੋ ਮੈਡਮ ਤੁਸੀਂ ਸਾਡੇ ਗੁੜ ਨੂੰ ਨਾ ਅੱਖਾਂ ਬੰਦ ਕਰਕੇ ਖਰੀਦ ਲਓ ਸਾਡਾ ਗੁੜ ਦੂਰੋਂ ਦੂਰ ਲੋਕੀ ਆਉਂਦੇ ਨੇ ਕਈ ਬੱਚੇ ਕੈਨੇਡਾ ਵੀ ਸਾਡਾ ਗੁੜ ਲੈ ਕੇ ਜਾਂਦੇ ਮੈਡਮ ਸਾਡੇ ਗੁੜ ਦੀ ਕੋਈ ਪੂਰੀ ਗਰੰਟੀ ਹੈ ਜਿੱਦਾਂ ਮਰਜ਼ੀ ਤੁਸੀਂ ਵਰਤੋ ਚਾਹ ਵਾਸਤੇ ਅਸੀਂ ਵੱਖਰਾ ਦਿੰਦੇ ਆ ਗੁੜ ਜਿਹੜਾ ਨੋਰਮਲ ਖਾਣ ਵਾਲਾ ਗੁੜ ਹੁੰਦਾ ਉਹ ਅਸੀਂ ਵੱਖਰਾ ਦਿੰਦੇ ਆ ਤੁਸੀਂ ਬਿਨਾਂ ਕਿਸੇ ਟੈਨਸ਼ਨ ਤੋਂ ਤੁਸੀਂ ਸਾਡਾ ਗੁੜ ਖਰੀਦ ਸਕਦੇ ਹੋ ਕੋਈ ਇਹਦੇ ਵਿੱਚ ਮਿਲਾਵਟ ਨਹੀਂ ਹੁੰਦੀ ਸਾਡੇ ਗੁੜ ਦੇ ਜੀ ਮੈਡਮ ਚੀਨੀ ਦੀ ਮਾਤਰਾ ਸਾਡੀ ਬਹੁਤ ਘੱਟ ਰਹਿੰਦੀ ਜੇ ਤੁਹਾਨੂੰ ਨਹੀਂ ਨਾ ਤਸੱਲੀ ਸਾਡੇ ਜਿੱਥੇ ਗੁੜ ਬਣਦਾ ਤੁਸੀਂ ਆ ਕੇ ਦੇਖਦੇ ਸਕਦੇ ਹੋ ਪੂਰਾ ਐਨ ਸਾਫ ਸੁਥਰੀ ਚੀਜ਼ਾਂ ਨਾਲ ਸਾਰੀ ਜਗਹਾ ਪਰ ਸਾਫ ਸੁਥਰੀ ਰੱਖ ਕੇ ਆਪਾਂ ਸਾਰਾ ਬਣਾਉਂਦੇ ਆਂ ਤੁਸੀਂ ਜਿਹੜਾ ਤੁਹਾਡਾ ਹਾਂਜੀ ਬਿਲਕੁਲ ਹਾਂ ਹਾਂ ਬਿਲਕੁਲ ਮੈਡਮ ਤੁਸੀਂ ਫਿਕਰ ਨਾ ਕਰੋ ਸਾਡਾ ਗੁੜ ਸਭ ਤੋਂ ਮੰਨਿਆ ਤੰਨਿਆ ਗੁੜ ਮੰਨਿਆ ਜਾਂਦਾ ਇਹਦੇ ਕਰਕੇ ਸਭ ਤੋਂ ਪਹਿਲਾਂ ਤੁਹਾਨੂੰ ਆਇਰਨ ਦੀ ਡੈਫੀਸ਼ੈਸੀ ਨਹੀਂ ਰਹਿੰਦੀ ਹੁਣ ਇਹਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਬਣਦਾ ਪੂਰੇ ਸਰੀਰ ਵਿੱਚ ਤੁਹਾਨੂੰ ਡਿਜੈਸ਼ਨ ਦੀ ਹਾਜ਼ਮੇ ਦੀ ਕੋਈ ਦਿੱਕਤ ਨਹੀਂ ਰਹਿੰਦੀ ਇਸ ਲਈ ਤੁਸੀਂ ਅੱਖਾਂ ਬੰਦ ਕਰਕੇ ਸਾਡਾ ਗੁੜ ਖਰੀਦ ਸਕਦੇ ਨਹੀਂ ਨਹੀਂ ਮੈਡਮ ਬਿਲਕੁਲ ਵੀ ਨਹੀਂ ਤਾਂ ਹੀ ਅਸੀਂ ਤੁਹਾਨੂੰ ਕਿਹਾ ਤੁਸੀਂ ਆਪ ਆ ਕੇ ਆਪਣੀ ਅੱਖੀਂ ਦੇਖ ਕੇ ਜਾਓ ਗੁੜ ਜਿੰਨਾ ਤੁਸੀਂ ਖਾਓਗੇ ਉਨਾ ਤੁਹਾਡੇ ਸ਼ਰੀਰ ਵਾਸਤੇ ਵਧੀਆ ਮੈਡਮ ਤੁਹਾਨੂੰ ਕਿਸ ਭਾਅ ਚਾਹੀਦਾ ਜੇ ਤਾਂ ਤੁਸੀਂ ਚੀਨੀ ਵਾਸਤੇ ਨਹੀਂ ਚੀਨੀ ਵਾਸਤੇ ਸਸਤਾ ਹੀ ਹ ਸਾਡਾ ਕੁਛ ਖਾਸ ਮਹਿੰਗਾ ਨਹੀਂ ਤੁਸੀਂ ਆ ਕੇ ਦੇਖ ਕੇ ਜਾਓ ਚੀਨੀ ਚਾਹ ਵਾਸਤੇ ਤੁਹਾਡਾ ਵੱਖਰਾ ਗੋੜ ਐ ਜਿਹੜਾ ਤੁਸੀਂ ਨੋਰਮਲ ਖਾਣਾ ਰੋਟੀ ਤੋਂ ਬਾਅਦ ਉਹਦੇ ਵਾਸਤੇ ਵੱਖਰੇ ਤਰਹਾਂ ਦਾ ਉਹ ਤੁਸੀਂ ਫਿਕਰ ਨਾ ਕਰੋ ਤੁਸੀਂ ਆਓ ਇੱਕ ਵਾਰ ਦੇਖ ਕੇ ਜਾਓ ਤੁਹਾਨੂੰ ਆਪ ਪਤਾ ਚੱਲੇਗਾ ਭੂਰੇ ਜਿੰਨਾ ਭੂਰਾ ਰੰਗ ਹੋਵੇ ਉਨਾ ਵਧੀਆ ਮੰਨਿਆ ਜਾਂਦਾ ਵੈਸੇ ਤਾਂ ਕਾਲਾ ਗੁਰ ਚਾਹ ਨੂੰ ਨਾ ਸਾੜ ਦਿੰਦਾ ਇਸ ਲਈ ਜਿੰਨਾ ਤੁਸੀਂ